ਹਾਂਜੀ

ਅੱਛਾ ਜੀ ਅੱਛਾ ਜੀ ਕਿਹੜੇ ਨਸ਼ੇ ਕਰਦਾ ਜੀ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਠੀਕ ਆ ਜੀ ਨਹੀਂ ਕੋਈ ਗੱਲ ਨਹੀਂ ਮੈਮ ਆਪਾਂ ਇੱਦਾਂ ਕਰਦੇ ਹਾਂ ਆਪਣੀ ਟੀਮ ਭੇਜ ਦਿੰਦਾ ਮੈਂ ਅਤੇ ਉਹ ਆ ਜਾਣਗੇ ਅਤੇ ਉਹਨਾਂ ਨੂੰ ਲੈ ਜਾਣਗੇ ਉੱਥੇ ਐਡਮਿਟ ਕਰਾ ਦੇਣਗੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਅਤੇ ਕੋਈ ਗੱਲ ਨਹੀਂ ਹੋ ਜਾਏਗਾ ਮੁੰਡਾ ਸੈੱਟ ਜੀ ਕੋਈ ਦਿੱਕਤ ਨਹੀਂ ਉਹਨਾਂ ਨੂੰ ਕਹੋ ਟੈਂਸ਼ਨ ਨਾ ਲਓ ਆਪਾਂ ਕਰਵਾ ਦਾਂਗੇ ਤੁਹਾਡਾ ਮਸਲਾ ਹੱਲ ਅਤੇ ਕੋਈ ਗੱਲ ਨਹੀਂ ਆਣ ਕੇ ਇੱਥੇ ਦਫ਼ਤਰ ਮੇਰੇ ਕੋਲ ਸੈਂਟਰ ਆਣ ਕੇ ਮੇਰੇ ਨਾ ਗੱਲ ਕਰ ਲਿਓ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ